ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੁਸੀਂ ਜਾਣਾ ਕਿੱਥੇ ਕਿੱਥੇ ਭਾਅ ਜੀ ਠੀਕ ਹੈ ਸਰ ਇੱਦਾਂ ਵਾ ਕਿ ਮੌਸਮ ਤਾਂ ਹੁਣ ਹਾਂ ਠੀਕ ਹੈ ਮੌਸਮ ਬਹੁਤ ਵਧੀਆ ਹੁਣ ਅਤੇ ਤੁਸੀਂ ਹੁਣ ਪ੍ਰੋਗਰਾਮ ਬਣਾ ਲਓ ਹਾਂਜੀ ਆਪਾਂ ਤਿੰਨ ਦਿਨ ਲਈ ਕਰਨਾ ਨਾ ਹਾਂਜੀ ਇੱਦਾਂ ਨਾ ਕਿ ਇੱਕ ਦਿਨ ਤੁਹਾਨੂੰ ਗੁਰਦੁਆਰਾ ਦਿਖਾਵਾਂਗੇ ਇੱਥੇ ਤਰਨ ਤਾਰਨ ਸਾਹਿਬ ਦਾ ਠੀਕ ਹੈ ਅਤੇ ਨਾਲ ਹੋਰ ਵੀ ਤਿੰਨ ਚਾਰ ਜਗ੍ਹਾ ਹੈਗੀਆਂ ਉਹ ਵੀ ਘੁਮਾਵਾਂਗੇ ਅਤੇ ਇੱਕ ਦਿਨ ਹਾਂਜੀ ਇੱਕ ਦਿਨ ਤੁਹਾਨੂੰ ਅਸੀਂ ਗੋਇੰਦਵਾਲ ਸਾਹਿਬ ਖੜਾਂਗੇ ਨਾਲ ਖਡੂਰ ਸਾਹਿਬ ਆ ਇਹ ਵੀ ਦਿਖਾਵਾਂਗੇ ਫਿਰ ਇੱਕ ਦਿਨ ਤੀਸਰੇ ਦਿਨ ਤੁਹਾਨੂੰ ਹਰੀਕੇ ਲੈ ਜਾਂਗੇ ਠੀਕ ਹੈ ਹਾਂਜੀ ਤੁਹਾਡੇ ਕੋਲ ਦਸ ਹਜ਼ਰ ਰੁਪਇਆ ਲਵਾਂਗੇ ਭਾਅ ਜੀ ਜਿਹਦੇ ਵਿੱਚੇ ਵਿੱਚੇ ਗੱਡੀ ਹੋ ਗਈ ਰਹਿਣ ਦਾ ਖਾਣ ਪੀਣ ਦਾ ਸਾਰਾ ਇੰਤਜ਼ਾਮ ਹੋਊਗਾ

ਜੀ ਸਤਿ ਸ਼੍ਰੀ ਅਕਾਲ ਜੀ